ਪੰਜਾਬੀ ਸਾਹਿਤ ਦੀ ਅਮੀਰ ਪਰੰਪਰਾ ਨੇ ਮੇਰੇ ਆਪਣੀ ਲਿਖਤ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਪੰਜਾਬੀ ਲੇਖਕਾਂ ਵਿੱਚੋਂ ਭਾਈ ਵੀਰ ਸਿੰਘ ਧਨੀ ਰਾਮ ਚਾਤ੍ਰਿਕ ਅੰਮਿਤਾ ਪ੍ਰੀਤਮ ਵਾਰਿਸ਼ ਸ਼ਾਹ ਬੁੱਲੇ ਸ਼ਾਹ ਬਾਬਾ ਫਰੀਦ ਮੋਹਨ ਸਿੰਘ ਆਦਿ ਵਰਗੇ ਰਾਈਟਰਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਮੈਂ ਉਹਨਾਂ ਦੀਆਂ ਕਵਿਤਾਵਾਂ ਨੂੰ ਪੜ੍ਹ ਪੜ੍ਹ ਕੇ ਆਪਣੀ ਲਿਖਤ ਵਿੱਚ ਸੁਧਾਰ ਕੀਤਾ ਹੈ ਮੇਰੀ ਆਪਣੀ ਰਚਨਾਤਮਕ ਕਲਾ ਬਹੁਤ ਪ੍ਰਭਾਵਿਤ ਹੋਈ ਹੈ ਜਿਸ ਨਾਲ ਮੈਂ ਆਪਣੀ ਲਿਖਤ ਨੂੰ ਹੋਰ ਵੀ ਵਧੀਆ ਬਣਾ ਸਕਦੀ ਹਾਂ ਮੈਂ ਉਹਨਾਂ ਦੀਆਂ ਹਰ ਕਵਿਤਾਵਾਂ ਨੂੰ ਪੜ੍ਹਦੀ ਹਾਂ ਅਤੇ ਉਹਨਾ ਦਾ ਵਾਰ ਵਾਰ ਅਭਿਆਸ ਕਰਦੀ ਰਹਿੰਦੀ ਹਾਂ